ਮੇਰੇ ਇਲਾਕੇ ਦੇ ਵਿੱਚ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਬਹੁਤ ਹੀ ਵਧੀਆ ਯੂਨੀਵਰਸਿਟੀ ਹੈ ਇਸਦੇ ਵਿੱਚ ਕਾਫੀ ਵਧੀਆ ਫੈਸਿਲਿਟੀ ਬੱਚਿਆਂ ਨੂੰ ਦਿੱਤੀ ਗਈ ਹੈ ਅਤੇ ਉਸ ਦੇ ਵਿੱਚ ਪੜ੍ਹਾਉਣ ਵਾਲੇ ਟੀਚਰ ਵੀ ਕਾਫੀ ਉੱਚ ਵਿੱਦਿਆ ਪ੍ਰਾਪਤ ਕਰਕੇ ਆਏ ਹੋਏ ਨੇ ਅਤੇ ਉਹ ਬੱਚਿਆਂ ਨੂੰ ਵੀ ਕਾਫੀ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ ਉਹ ਬੱਚਿਆਂ ਦਾ ਹਰ ਇੱਕ ਡਾਊਟ ਵਧੀਆ ਤਰੀਕੇ ਨਾਲ ਕਲੀਅਰ ਕਰਦੇ ਨੇ ਅਤੇ ਇਸ ਤੋਂ ਇਲਾਵਾ ਜੇ ਵੇਖਿਆ ਜਾਏ ਤਾਂ ਇੱਥੇ ਖੇਡਾਂ ਦੇ ਗਰਾਊਂਡ ਵੀ ਕਾਫੀ ਵਧੀਆ ਵਧੀਆ ਬਣਾਏ ਗਏ ਨੇ ਇਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਖੇਡਾਂ ਵੀ ਖਿਡਾਈਆਂ ਜਾਂਦੀਆਂ ਨੇ ਜਿਵੇਂ ਫੁੱਟਬਾਲ ਕ੍ਰਿਕਟ ਚੇਸ ਬਾਸਕਿਟਬਾਲ ਆਦਿ ਅਤੇ ਇਸ ਤੋਂ ਇਲਾਵਾ ਜੇ ਹੋਰ ਦੱਸਿਆ ਜਾਏ ਤਾਂ ਇਹਦਾ ਪਲੇਸਮੈਂਟ ਵਾਲਾ ਵੀ ਕਾਫੀ ਵਧੀਆ ਸਿਸਟਮ ਹੈ ਕਾਫੀ ਬੱਚਿਆਂ ਨੂੰ ਵਧੀਆ ਵਧੀਆ ਪਲੇਸਮੈਂਟ ਇਹਦੇ ਦੁਆਰਾ ਕੀਤੀ ਗਈ ਹੈ ਅਤੇ ਨਾਲ ਇਸ ਦੇ ਵਿੱਚ ਜਿਹੜੇ ਹੋਸਟਲ ਨੇ ਉਹ ਵੀ ਕਾਫੀ ਵਧੀਆ ਨੇ ਅਤੇ ਇੱਥੇ ਕੁਝ ਵੀ ਮਾੜੀਆਂ ਆਦਤਾਂ ਨਹੀਂ ਲਾਉਂਦੇ ਅਤੇ ਇਹ ਸਭ ਤੋਂ ਵਧੀਆ ਯੂਨੀਵਰਸਿਟੀ ਹੈ ਮੇਰੇ ਇਲਾਕੇ ਦੇ ਵਿੱਚ